ਸੱਤ ਫਰਵਰੀ ਉੱਨੀ ਸੌ ਸਤਾਨਵੇਂ ਅਠਾਰਾਂ ਜਨਵਰੀ ਦੋ ਹਜ਼ਾਰ ਵੀਹ ਅਕਤੂਬਰ ਉੱਨੀ ਸੌ ਸਤਾਸੀ ਤੇਈ ਸਤੰਬਰ ਦੋ ਹਜ਼ਾਰ ਦੋ ਅੱਠ ਅਗਸਤ ਉੱਨੀ ਸੌ ਸੰਤਾਲੀ